ਜੇ ਭਾਰਤੀ ਸਿਨਮਾ ਅਤੇ ਸੰਗੀਤ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਪ੍ਰਕਾਰ ਦਾ ਮਿਊਜ਼ਿਕ ਬਹੁਤ ਪ੍ਰਕਾਰ ਦੀਆਂ ਫਿਲਮਾਂ ਪਾਈਆਂ ਜਾਂਦੀਆਂ ਨੇ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਪਾਈਆਂ ਜਾਂਦੀਆਂ ਨੇ ਅਤੇ ਮ ਮੈਨੂੰ ਮੋਸਟਲੀ ਪਨ ਪੰਜਾਬੀ ਫਿਲਮਾਂ ਬਹੁਤ ਪਸੰਦ ਨੇ ਪੰਜਾਬੀ ਫਿਲਮਾਂ ਵਿੱਚ ਉਹ ਫਿਲਮਾਂ ਜਿਹੜੀਆਂ ਸਾਡੇ ਕਲਚਰ ਨਾਲ ਜੁੜੀਆਂ ਹੋਈਆਂ ਨੇ ਸਾਡੇ ਦੇਸ਼ ਨਾਲ ਜੁੜੀਆਂ ਹੋਈਆਂ ਨੇ ਸਾਡੀ ਨੌਜਵਾਨ ਪੀੜੀ ਲਈ ਜੋ ਪਰੇਸ਼ਾਨੀਆਂ ਹਨ ਅੱਜ ਕੱਲ੍ਹ ਹਰੇਕ ਦਾ ਉਹ ਮੰਤਵ ਹੁੰਦਾ ਕਿ ਬਾਹਰ ਜਾਣਾ ਬਾਹਰ ਜਾਣਾ ਅਤੇ ਇਸ ਬਾਹਰ ਜਾਣ ਨੂੰ ਲੈ ਕੇ ਉਹਨਾਂ ਨੂੰ ਬਾਹਰ ਜਾ ਕੇ ਕਿੰਨਾ ਸੰਘਰਸ਼ ਕਰਨਾ ਪੈਂਦਾ ਇਸ ਨਾਲ ਜੁੜੀ ਫਿਲਮ ਹੈ ਚੱਲ ਮੇਰਾ ਪੁੱਤ ਜੋ ਕਿ ਅਮਰਿੰਦਰ ਗਿੱਲ ਦੀ ਹੈ ਅਤੇ ਉਹ ਫਿਲਮ ਮੈਨੂੰ ਬਹੁਤ ਪਸੰਦ ਹੈ ਉਹਦੇ ਵਿੱਚ ਬਾਹਰ ਜਾ ਕੇ ਜੋ ਸੰਘਰਸ਼ ਹੈ ਬੱਚਿਆਂ ਨੂੰ ਕਰਨਾ ਪੈਂਦਾ ਹੈ ਕਿੰਨੀ ਦੂਰ ਰਹਿੰਦੇ ਨੇ ਮਾਂ ਬਾਪ ਤੋਂ ਕੀ ਕੀ ਸਹਿਣਾ ਪੈਂਦਾ ਉਹ ਸਾਰੀਆਂ ਚੀਜ਼ਾਂ ਬਹੁਤ ਦੇਖਣ ਨੂੰ ਸਮਝਣ ਨੂੰ ਇੱਕ ਸਿੱਖਿਆ ਦੇ ਤੌਰ 'ਤੇ ਲੱਗਦੀਆਂ ਨੇ ਉਹ ਬਹੁਤ ਮੈਨੂੰ ਵਧੀਆ ਲੱਗਦਾ ਹੈ ਅਮਰਿੰਦਰ ਗਿੱਲ ਹੀ ਮੇਰਾ ਫੇਵਰੇਟ ਐਕਟਰ ਵੀ ਹੈ ਅਤੇ ਫੇਵਰੇਟ ਸਿੰਗਰ ਵੀ ਹੈ ਅਤੇ ਚੱਲ ਮੇਰਾ ਪੁੱਤ ਵਿੱਚ ਬਹੁਤ ਖੂਬਸੂਰਤ ਗਾਣਾ ਹੈ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਇਹ ਮੇਰਾ ਫੇਟਰੇਟ ਸੌਂਗ ਹੈ ਜੋ ਅਮਰਿੰਦਰ ਗਿੱਲ ਜੀ ਨੇ ਗਾਇਆ ਹੈ ਅਤੇ ਮੇਰੀ ਫੇਵਰੇਟ ਫਿਲਮ ਵੀ ਹੈ ਚੱਲ ਮੇਰਾ ਪੁੱਤ ਅਤੇ ਮੇਰਾ ਪਸੰਦੀਦਾ ਗਾਇਕ ਵੀ ਅਮਰਿੰਦਰ ਗਿੱਲ ਹੈ